ਮੇਰੀ ਹੱਥ ਦੀ ਬਣਾਈ ਰੈਸਪੀ ਵਿੱਚ ਜਾਂ ਮੈਂ ਕਿ ਰਸੋਈ ਵਿੱਚ ਜੋ ਵੀ ਖਾਣ ਲਈ ਕੁਝ ਵੀ ਬਣਾਉਂਦੀ ਹਾਂ ਉਸ ਵਿੱਚ ਬਹੁਤ ਸਾਰੀਆਂ ਸਮੱਗਰੀਆਂ ਵਰਤੀਆਂ ਜਾਂਦੀਆਂ ਹਨ ਜਿਵੇਂ ਮੇਰੀ ਹੱਥ ਦੀ ਬਣਾਈ ਰੈਸਪੀ ਵਿੱਚ ਖ਼ਾਸ ਚੀਜ਼ ਹੁੰਦੀ ਆ ਮਸਾਲਿਆਂ ਦੀ ਜਿਵੇਂ ਕਿ ਕੋਈ ਚੀਜ਼ ਬਣਾਉਣੀ ਜੀਰੇ ਦਾ ਤੜਕਾ ਲਾਉਣਾ ਮਸਾਲੇ ਹਰ ਚੀਜ਼ ਬਣਾਉਣ ਵਿੱਚ ਮੈਂ ਮਸਾਲੇ ਆਪ ਖੁਦ ਤਿਆਰ ਕਰਦੀ ਹਾਂ ਜਿਵੇਂ ਕਿ ਮੋਟੀ ਇਲਾਇਚੀ ਹੋ ਗਈ ਜੀਰਾ ਹੋ ਗਿਆ ਗਰਮ ਮਸਾਲਾ ਹੋ ਗਿਆ ਦਾਲ ਚੀਨੀ ਹੋ ਗਈ ਮਗਾ ਹੋ ਗਈਆਂ ਇਹਨਾਂ ਨੂੰ ਥੋੜ੍ਹਾ ਜਿਹਾ ਮੈਂ ਰੋਸਟ ਕਰਦੀ ਹਾਂ ਫਿਰ ਇਹਨਾਂ ਦਾ ਮੈਂ ਪੀਸ ਕੇ ਇਨ੍ਹਾਂ ਦਾ ਗਰਮ ਮਸਾਲਾ ਖੁਦ ਤਿਆਰ ਕਰਦੀ ਹਾਂ ਇਸ ਨਾਲ ਮੇਰੀ ਬਣਾਈ ਸਮੱਗਰੀ ਬਹੁਤ ਹੀ ਸਵਾਦ ਬਣਦੀ ਹੈ ਅਤੇ ਬਾਕੀ ਕਹਿੰਦੇ ਹੈ ਕਿ ਵੀ ਬਣਾਉਣ ਵਾਲੇ ਦੇ ਥੋੜ੍ਹਾ ਹੱਥ ਦਾ ਵੀ ਸਵਾਦ ਆਉਂਦਾ ਵਾ ਕਿ ਜੋ ਵੀ ਇਹੀ ਮਸਾਲੇ ਜੇ ਕੋਈ ਹੋਰ ਵੀ ਪਾ ਜਾਵੇ ਤਾਂ ਉਹਦਾ ਸਵਾਦ ਹੱਥ ਦਾ ਹੋਰ ਹੋਏਗਾ ਥੋੜ੍ਹਾ ਜਿਹਾ ਇਹ ਮੈਂ ਮੰਨਦੀ ਹਾਂ ਕਿ ਆਪ ਕਿਸੇ ਦੇ ਹੱਥ ਦੇ ਸਵਾਦ ਹੀ ਇਸ ਤਰ੍ਹਾਂ ਦਾ ਹੁੰਦਾ ਕਿ ਆਪਣੇ ਚੀਜ਼ ਸਵਾਦ ਲੱਗਦੀ ਹੈ ਇਸ ਤਰ੍ਹਾਂ ਮੇਰੀ ਜਿਵੇਂ ਕਿ ਇਲਾਇਚੀ ਕੋਈ ਮਸਾਲਾ ਮੈਂ ਖੁਦ ਘਰ ਤਿਆਰ ਕਰਦੀ ਹਾਂ ਜਿਵੇਂ ਇਲਾਇਚੀ ਪਾ ਲੈਂਦੀ ਹਾਂ ਮੋਟੀ ਇਲਾਇਚੀ ਛੋਟੀ ਇਲਾਇਚੀ ਇਹਨਾਂ ਦੇ ਮਸਾਲੇ ਮੈਂ ਖੁਦ ਤਿਆਰ ਕਰਦੀ ਹਾਂ ਚਾਹ ਦਾ ਮਸਾਲਾ ਮੈਂ ਖੁਦ ਤਿਆਰ ਕਰਦੀ ਹਾਂ ਇਹ ਮਸਾਲਾ ਸਬਜ਼ੀਆਂ ਵਿੱਚ ਪਾਉਣ ਨਾਲ ਸਬਜ਼ੀਆਂ ਦੀ ਮਹਿਕ ਬਹੁਤ ਹੀ ਵਧੀਆ ਆਉਂਦੀ ਹੈ ਔਰ ਸਬਜ਼ੀਆਂ ਦਾ ਸਵਾਦ ਬਹੁਤ ਹੀ ਵਧੀਆ ਬਣਦਾ ਹੈ ਮੇਰੀ ਹ ਬਣਾਈ ਹੱਥ ਦੀ ਰੈਸਪੀ ਸੁਗੰਧੀ ਸੁਗੰਧ ਦੇ ਨਾਲ ਹੀ ਭੁੱਖ ਹੋਰ ਵੱਧ ਜਾਂਦੀ ਹੈ ਇਹ ਭਾਂਤ ਭਾਂਤ ਦੀਆਂ ਸਮੱਗਰੀਆਂ ਮੈਂ ਜਿਹੜੀ ਹਲਦੀ ਹੈ ਉਹ ਉਹ ਵੀ ਖੁਦ ਹੀ ਘਰ ਆਪ ਪਿਸਵਾਨੀ ਹਾਂ ਬਜ਼ਾਰੋਂ ਕੱਚੀ ਹਲਦੀ ਲਿਆ ਕੇ ਉਸਨੂੰ ਖੁਦ ਘਰ ਆਪ ਪੀਹ ਕੇ ਉਹ ਬਣਾਉਂਦੀ ਹਾਂ ਧੰਨਵਾਦ